ਟੈਕਨੋਲੋਜੀ ਦੀ ਵਰਤੋਂ ਨੇ ਸੰਸਾਰ ਵਿੱਚ ਸਾਡੇ ਆਲੇ ਦੁਆਲੇ ਦੀ ਗੱਲ ਕਰਦੇ ਅਤੇ ਕਰਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਪਹਿਲਾਂ ਜਿੱਥੇ ਇੱਕ ਇਨਸਾਨ ਦੂਰ ਚਲਾ ਜਾਵੇ ਜਾਂ ਬਾਹਰਲੇ ਦੇਸ਼ 'ਚ ਚਲਾ ਜਾਵੇ ਤਾਂ ਉਹ ਬਹੁਤ ਦੂਰ ਮਹਿਸੂਸ ਹੁੰਦਾ ਸੀ ਟੈਕਨੋਲੋਜੀ ਨੇ ਉਹਨੂੰ ਸਾਡੇ ਬਹੁਤ ਨੇੜੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਟੈਕਨੋਲੋਜੀ ਦੇ ਵਿੱਚ ਸੋਸ਼ਲ ਮੀਡੀਆ ਦਾ ਅਹਿਮ ਰੋਲ ਹੈ ਇਨਸਾਨਾਂ ਦੀ ਜ਼ਿੰਦਗੀ ਬਾਰੇ ਦੱਸਣ ਦਾ ਪਹਿਲਾਂ ਜਦ ਸਾਨੂੰ ਕਿਸੇ ਦੋਸਤ ਬਾਰੇ ਨਹੀਂ ਪਤਾ ਹੁੰਦਾ ਸੀ ਉਹ ਦੂਰ ਹੁੰਦਾ ਸੀ ਵਿਛੋੜਾ ਸ ਵਿਛੋੜਾ ਲੱਗਦਾ ਸੀ ਉਹਦਾ ਹੁਣ ਇਹ ਵਿਛੋੜੇ ਖਤਮ ਕਰਤੇ ਸੋਸ਼ਲ ਮੀਡੀਆ ਨੇ ਪਰ ਇਹਦੇ ਨਾਲ ਨਾਲ ਇੱਕ ਹੋਰ ਮੁ ਮੁਸੀਬਤ ਵੀ ਹੈ ਕਿ ਇਨਸਾਨ ਇਨਸਾਨ ਦੇ ਇੰਨੇ ਨੇੜੇ ਹੋ ਕੇ ਇੰਨੇ ਗੱਲ ਨਹੀਂ ਕਰਦਾ ਕਿਉਂਕਿ ਉਹ ਸੋਸ਼ਲ ਮੀਡੀਆ 'ਚ ਡੁੱਬਿਆ ਰਹਿੰਦਾ ਹੈ ਸੋਸ਼ਲ ਮੀਡੀਆ 'ਚ ਦਿਖਾਵਾ ਬਹੁਤ ਜ਼ਿਆਦਾ ਹੋ ਗਿਆ ਹੈ ਇਨਸਾਨ ਸੱਚਾਈ ਤੋਂ ਦੂਰ ਭੱਜਦਾ ਜਾ ਰਿਹਾ ਹੈ ਇਕ ਐਸੀ ਦੁਨੀਆਂ 'ਚ ਖੋ ਗਿਆ ਹੈ ਜੋ ਉਹਦੀ ਅਸਲੀਅਤ ਨਹੀਂ ਹੈ ਇੱਕ ਆਰਾਮ ਇੱਕ ਦੀ ਜ਼ਿੰਦਗੀ ਜੀਣ ਦੀ ਬਜਾਏ ਉਹ ਸਿਰਫ ਦੁਨੀਆਂ ਨੂੰ ਦਿਖਾਵੇ ਦੀ ਜ਼ਿੰਦਗੀ ਜੀਂਦਾ ਹੈ ਸੋਸ਼ਲ ਮੀਡੀਆ ਨੇ ਸ ਬਹੁਤ ਜ਼ਿਆਦਾ ਨੁਕਸਾਨ ਵੀ ਹਨ ਅਤੇ ਫਾਇਦੇ ਵੀ ਹਨ ਦੋਸਤ ਬਹੁਤ ਨੇ ਲੋਕਾਂ ਦੇ ਸੋਸ਼ਲ ਮੀਡੀਆ 'ਤੇ ਪਰ ਅਸਲੀਅਤ 'ਚ ਕੰਮ ਆਉਣ ਵਾਲੇ ਦੋਸਤ ਲੱਭਣੇ ਮੁਸ਼ਕਿਲ ਹੋ ਗਏ ਹਨ